ਹਾਂ ਮੈਂ ਬਹੁਤ ਸਾਰੇ ਰਾਸ਼ਟਰੀ ਮੁਕਰਾਜ ਦੇ ਵਿੱਚ ਜਿਹੜੇ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲੇ ਹੋਏ ਨੇ ਮੈਂ ਬਹੁਤ ਪਾਰਟੀਸਪੇਟ ਕੀਤੇ ਨੇ ਮੇਰਾ ਡਰਾਇੰਗ ਦਾ ਕੰਪੀਟੀਸ਼ਨ ਮੈਂ ਰਾਸ਼ਟਰੀ ਲੈਵਲ 'ਤੇ ਕੀਤਾ ਸਟੇਟ ਲੈਵਲ ਦਾ ਅਲੱਗ ਸੀ ਸਭ 'ਤੇ ਅਲੱਗ ਅਲੱਗ ਮੇਰਾ ਤਜ਼ਰਬਾ ਰਿਹਾ ਹੈ ਉਹਨਾਂ ਨੂੰ ਕਰਨ ਦਾ ਕਾਫੀ ਕੁਛ ਸਿੱਖਣ ਤੋਂ ਮਿਲਿਆ ਕੁਛ ਨੈਗਟਿਵ ਪੁਆਇੰਟ ਵੀ ਮਿਲੇ ਕੁਛ ਪੋਜੀਟਿਵ ਬਹੁਤ ਅੱਛੇ ਪੋਜੀਟਿਵ ਵੀ ਮਿਲੇ ਅਤੇ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਪਰ ਮੈਂ ਅੰਤਰਰਾਸ਼ਟਰੀ ਕਦੇ ਵੀ ਨਹੀਂ ਗਈ ਜਾ ਸਕੀ ਪਰ ਜੋ ਮੈਂ ਰਾਸ਼ਟਰੀ ਰਾਜ ਤੋਂ ਮੈਂ ਸਿੱਖਿਆ ਏ ਉਹ ਮੈਂ ਅੱਜ ਆਪਦੇ ਪ੍ਰੋਫੈਸ਼ਨ ਵਿੱਚ ਉਹਨੂੰ ਕੰਮ ਕਰ ਰਹੀ ਹਾਂ ਅਤੇ ਉਹਦੇ 'ਚ ਮੈਨੂੰ ਬਹੁਤ ਉਹਦੀ ਸਹਾਇਤਾ ਮਿਲ ਰਹੀ ਏ ਉਸ ਤਜ਼ਰਬੇ ਦਾ ਮੈਂ ਅੱਜ ਪੂਰਾ ਫਾਇਦਾ ਉਠਾ ਰਹੀ ਹਾਂ ਉਸ ਕੰਮ ਦਾ ਅਤੇ ਬਹੁਤ ਖੁਸ਼ੀ ਵੀ ਹੁੰਦੀ ਹੈ ਉਸ ਚੀਜ਼ ਨੂੰ ਲੈ ਕੇ ਅਤੇ ਕਾਫੀ ਕੁਛ ਮੈਂ ਸਿੱਖਿਆ ਨਵਾਂ